ਜੀ ਹਾਂ ਮੇਰੇ ਖੇਤਰ ਦੇ ਹਸਪਤਾਲਾਂ ਵਿੱਚ ਐਕਸਰੇ ਸਿਟੀ ਸਕੈਨ ਅਤੇ ਐਮ ਆਰ ਆਈ ਸਕੈਨ ਲਈ ਉੱਨਤ ਟੂਲ ਮੌਜੂਦ ਹਨ ਮੈਂ ਸਾਨੂੰ ਕਿਸੇ ਵੀ ਟੈਸਟ ਖੂਨ ਦੀ ਜਾਂਚ ਪਿਸ਼ਾਬ ਦੀ ਜਾਂਚ ਸਿਟੀ ਸਕੈਨ ਬਲੱਡ ਪ੍ਰੈਸ਼ਰ ਦੀ ਜਾਂਚ ਆਦਿ ਕਰਵਾਉਣ ਲਈ ਸਾਨੂੰ ਕਿਤੇ ਹੋਰ ਕਿਸੇ ਵੀ ਹੋਸਪਿਟਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਡੇ ਖੁਦ ਸ਼ਹਿਰ ਵਿੱਚ ਵਧੀਆ ਹਸਪਤਾਲ ਹੈ ਅਤੇ ਉਸ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਐਕਸਰੇ ਸਭ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ ਸਾਨੂੰ ਆਪਣੇ ਲਈ ਕਿਤੇ ਵੀ ਹੋਰ ਜਾਣ ਦੀ ਜ਼ਰੂਰਤ ਨਹੀਂ ਉੱਥੇ ਹਰ ਇੱਕ ਤਰ੍ਹਾਂ ਦਾ ਟੈਸਟ ਕੀਤਾ ਜਾਂਦਾ ਹੈ ਜਿਵੇਂ ਕਿ ਖੂਨ ਦਾ ਪਿਸ਼ਾਬ ਦਾ ਸੀਟੀ ਸਕੈਨ ਆਦਿ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਇਸ ਲਈ ਸਾਨੂੰ ਆਪਣੇ ਟੈਸਟਾਂ ਲਈ ਕਿਤੇ ਵੀ ਜਾਣ ਦੀ ਕੋਈ ਜ਼ਰੂਰਤ ਨਹੀਂ ਸੋ ਇਸ ਲਈ ਅਸੀਂ ਆਪਣੇ ਸ਼ਹਿਰ ਦੇ ਹਸਪਤਾਲ ਵਿੱਚ ਹੀ ਆਪਣਾ ਇਲਾਜ ਕਰਵਾਉਂਦੇ ਹਾਂ